ਹੈਲੋ ਹਾਂਜੀ ਸ੍ਰੀਮਾਨ ਜੀ ਮੈਂ ਕੁਲਦੀਪ ਸਿੰਘ ਬੋਲ ਰਿਹਾ ਜੀ ਮੈਂ ਅੱਜ ਸਤਾਰਾਂ ਜਨਵਰੀ ਦੋ ਹਜ਼ਾਰ ਚੌਵੀ ਦੇ ਲਈ ਇੱਕ ਕੈਬ ਬੁੱਕ ਕੀਤੀ ਸੀ ਤੁਹਾਡੀ ਕੰਪਨੀ ਵੱਲੋਂ ਅਤੇ ਕੁਝ ਕਾਰਨਾਂ ਕਰਕੇ ਅਸਲ ਦੇ ਵਿੱਚ ਇਸ ਇਲਾਕੇ ਵਿੱਚ ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈ ਇਸ ਕਰਕੇ ਮੇਰੀ ਮੈਂ ਰੇਲਵੇ ਸਟੇਸ਼ਨ ਜਾਣਾ ਸੀ ਅਤੇ ਟਰੇਨ ਮੇਰੀ ਲੇਟ ਹੋ ਗਈ ਹੈ ਜੀ ਅਤੇ ਉਸ ਕਰਕੇ ਮੈਨੂੰ ਇਹ ਤੁਹਾਡੀ ਜਿਹੜੀ ਕੈਬ ਹੈਗੀ ਆ ਇਹ ਕੈਂਸਲ ਕਰਨੀ ਪੈ ਰਹੀ ਆ ਅਤੇ ਮੈਂ ਤੁਹਾਨੂੰ ਬੇਨਤੀ ਇਸ ਸੰਬੰਧ ਦੇ ਵਿੱਚ ਬੇਨਤੀ ਕਰਨੀ ਸੀ ਕਿ ਕਿਉਂਕਿ ਮੈਂ ਡਰਾਈਵਰ ਨੂੰ ਔਨਲਾਈਨ ਪਹਿਲਾਂ ਹੀ ਇਸਦਾ ਭੁਗਤਾਨ ਕਰ ਚੁੱਕਿਆ ਸੀ ਅਤੇ ਤੁਹਾਨੂੰ ਬੇਨਤੀ ਹੈ ਕਿ ਹੁਣ ਮੈਨੂੰ ਕੈਬ ਰੱਦ ਕਰਨੀ ਪੈ ਰਹੀ ਹੈ ਅਤੇ ਤੁਸੀਂ ਜਿਹੜਾ ਮੇਰੇ ਵੱਲੋਂ ਕੀਤਾ ਗਿਆ ਭੁਗਤਾਨ ਆ ਉਹਨੂੰ ਮੇਰੇ ਉਬਰ ਵਾਲਟ ਦੇ ਵਿੱਚ ਵਾਪਸ ਰੀਫੰਡ ਕਰ ਦਿਉ ਤਾਂ ਕਰਕੇ ਕਿ ਮੈਂ ਇਸ ਜਿਹੜੀ ਇਹ ਪੇਮੈਂਟ ਹੋਏਗੀ ਇਹਨੂੰ ਅੱਗੋਂ ਅਗਾਉਂ ਕਿਸੇ ਹੋਰ ਕੈਬ ਬੁਕਿੰਗ ਵਾਸਤੇ ਵਰਤ ਸਕਾਂ ਅਤੇ ਬਸ ਤੁਹਾਨੂੰ ਇਹੀ ਬੇਨਤੀ ਹੈ ਜੀ ਅਤੇ ਮੈਂ ਆਪਣੇ ਵੱਲੋਂ ਮਾਫੀ ਵੀ ਮੰਗਦਾ ਕਿ ਕਈ ਸਿਚੁਏਸ਼ਨ ਜਿਹੜੀ ਸਥਿਤੀ ਹੈਗੀ ਸੀ ਉਹ ਇਸ ਤਰ੍ਹਾਂ ਦੀ ਸੀ ਕਿ ਮੈਨੂੰ ਬੁਕ ਕੈਂਸਲ ਕਰਨਾ ਪਿਆ ਤੁਹਾਡਾ ਇਹ ਕੈਬ ਬੁਕਿੰਗ ਦਾ ਆਡਰ ਹਾਂਜੀ ਹਾਂਜੀ ਸੋ ਧੰਨਵਾਦ ਜੀ ਥੈਂਕ ਯੂ